ਹੈਲੋ ਸਰ ਆਪਣੇ ਤੁਸੀਂ ਸ਼ਟੇਸ਼ਨਰੀ ਤੋਂ ਬੋਲਦੇ ਜੀ ਸਰ ਆਪਣੀ ਸ਼ਟੇਸ਼ਨਰੀ ਕਿੱਥੇ ਜਿਹੀ ਕਰਕੇ ਹੈ ਜੀ ਹਾਂਜੀ ਹਾਂਜੀ ਅਸ਼ੋਕ ਕੁਮਾਰ ਸੈਂਟਰ ਹਾਂਜੀ ਸਰ ਆਪਾਂ ਨੂੰ ਕੁਛ ਰਜਿਸਟਰ ਵਗੈਰਾ ਅਤੇ ਕਾਪੀਆਂ ਵਗੈਰਾ ਚਾਹੀਦੀਆਂ ਸੀ ਬੱਚੇ ਵਾਸਤੇ

ਆਪਾਂ ਨੂੰ ਛੋਟੀਆਂ ਵੀ ਚਾਹੀਦੀਆਂ ਸੀ ਅਤੇ ਵੱਡੇ ਰਜਿਸਟਰ ਵੀ ਚਾਹੀਦੇ ਸੀ ਮੋਟੇ ਹਾਂਜੀ ਹਾਂਜੀ ਅੱਛਾ ਜੀ ਅਤੇ ਸਰ ਆਪਣੇ ਛੋਟੀ ਕਾਪੀਆਂ ਅਤੇ ਰਜਿਸਟਰਾਂ ਦਾ ਪ੍ਰਾਈਜ ਕੀ ਕੀ ਹੈ ਜੀ ਹਾਂਜੀ ਹਾਂਜੀ ਅਤੇ ਆਪ

ਹਾਂਜੀ ਅਤੇ ਆਪਣੇ ਸਰ ਜਿਹੜੇ ਇਹਨਾਂ ਦਾ ਪ੍ਰਾਈਜ ਕੀ ਚੱਲਦਾ ਜੀ ਰਫ ਕਾਫੀ ਦਾ ਹਾਂਜੀ

ਅਤੇ ਸਰ ਆਪਣੇ ਜਿੰਨਦੇ ਰਫ 'ਚ ਰਜਿਸਟਰ ਆਉਂਦੇ ਜੀ

ਹਾਂਜੀ ਹਾਂਜੀ

ਇ ਇਹਨਾਂ ਦੇ ਸਰ ਆਪਾਂ ਨੂੰ ਕਵਰ ਵਗੈਰਾ ਮਿਲ ਜਾਣਗੇ ਅੱਛਾ ਜੀ ਸਰ ਅਤੇ ਆਪਣੇ ਇਹਨਾਂ ਦਾ ਪ੍ਰਾਈਜ਼ ਕੀ ਹੈ ਕਵਰਾਂ ਦਾ

ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਅਤੇ ਆਪਣੇ ਕੋਲ ਸਰ ਅੱਠਵੀਂ ਕਲਾਸ ਦੇ ਬੁੱਕ ਮਿਲ ਜਾਣਗੀਆ ਜੀ ਹਾਂਜੀ ਹਾਂਜੀ ਅਤੇ ਇਹਨਾਂ ਦੇ ਆਪਣੇ ਪ੍ਰਾਈਜ਼ ਕੀ ਕੀ ਹੈ ਜੀ ਬੁਕਸ ਦਾ ਬੁਕਸ ਦਾ ਹਾਂਜੀ ਹਾਂਜੀ

ਅਤੇ ਆਪਣੇ ਸ ਹਾਂਜੀ ਅਤੇ ਆਪਣੇ ਕੋਲ ਸ ਭਾਅ ਜੀ ਇਹ ਜੇ ਆਪਣੇ ਜੋ ਫਾਈਲ ਵਗੈਰਾ ਮਿਲ ਜੂਗੀ

ਹਾਂਜੀ ਅਤੇ ਅਤੇ ਆਪਣੇ ਕੋਲ ਕਲਰ ਸ਼ਾਪਿੰਗ ਪੈਂਸਲ ਵਗੈਰਾ ਦੀ ਮਿਲ ਜਾਣਗੇ ਜੀ ਠੀਕ ਹੈ ਸਰ ਥੈਂਕ ਯੂ